ਵੱਖ ਵੱਖ ਮੌਸਮ 'ਚ ਦੋੜਨ ਦਾ ਸਵਾਦ ਸੁ ਸੁਝਾਅ ਜਿਵੇਂ ਕੀ ਗਰਮੀਆਂ 'ਚ ਦੌੜਦੇ ਸਮੇਂ ਸਾਨੂੰ ਆਪਣਾ ਖਿਆਲ ਰੱਖਣਾ ਹੈ ਕੀ ਅਸੀਂ ਗਰਮੀ 'ਚ ਦੁਪਹਿਰ ਦੇ ਸਮੇਂ ਨਹੀਂ ਦੌੜੀਏ ਸਵੇਰੇ ਸ਼ਾਮ ਸਾਨੂੰ ਦੌੜਨਾ ਚਾਹੀਦਾ ਹੈ ਅਤੇ ਖੁੱਲੇ ਕੱਪੜੇ ਪਾ ਕੇ ਹੀ ਗਰਮੀਆਂ 'ਚ ਸਾਨੂੰ ਦੌੜ ਲਗਾਣੀ ਚਾਹੀਦੀ ਹੈ ਜਿਸ ਕਰਕੇ ਅਸੀਂ ਸਾਡਾ ਸਰੀਰ ਖੁੱਲਾ ਰਹੇ ਸਰੀਰ ਨੂੰ ਹਵਾ ਵੀ ਲੱਗਦੀ ਰਹੇ ਠੀਕ ਹੈ ਗਰਮੀ ਜ਼ਿਆਦਾ ਹੋਣ ਕਾਰਨ ਸਾਨੂੰ ਚੱਕਰ ਨਾ ਆ ਜਾਣ ਅਤੇ ਸਾਨੂੰ ਸਾਡਾ ਬੀ ਪੀ ਨਾ ਵੱਧ ਜਾਵੇ ਬੀ ਪੀ ਵਧਣ ਨਾਲ ਅਸੀਂ ਡਿੱਗ ਵੀ ਸਕਦੇ ਹਨ ਜੇ ਜ਼ਿਆਦਾ ਗਰਮੀ 'ਚ ਜਾਓਗੇ ਤਾਂ ਸਾਨੂੰ ਅਸੀਂ ਡਿੱਗ ਸਕਦੇ ਹਨ ਅਤੇ ਹਰ ਟਾਈਮ ਦੌੜਦੇ ਸਮੇਂ ਸਾਨੂੰ ਬੂਟ ਪਾ ਕੇ ਰੱਖਣੇ ਚਾਹੀਦੇ ਹਨ ਗਰਮੀਆ 'ਚ ਸਾਨੂੰ ਨਿੱਕਰ ਪਾ ਕੇ ਹੀ ਦੌੜਨਾ ਚਾਹੀਦਾ ਜਾਂ ਖੁੱਲਾ ਕੁੜਤਾ ਪਜਾਮਾ ਪਾ ਕੇ ਦੌੜਨਾ ਚਾਹੀਦਾ ਹੈ ਅਤੇ ਸਰਦੀਆਂ ਦੇ ਵਿੱਚ ਸਾਨੂੰ ਗਰਮ ਸੂਟ ਟਰੈਕ ਸੂਟ ਹੋਵੇ ਜਿਵੇਂ ਜਿਵੇਂ ਕੀ ਅਤੇ ਚਮਕੀਲੇ ਕੱਪੜੇ ਪਾ ਕੇ ਹੀ ਦੌੜਨਾ ਚਾਹੀਦਾ ਹੈ ਕਿਉਂਕਿ ਗਰਮ ਸਰਦੀਆਂ 'ਚ ਧੁੰਦ ਪਈ ਹੋਈ ਹੁੰਦੀ ਹੈ ਧੁੰਦ ਦੇ ਕਾਰਨ ਹਨੇਰਾ ਹੁੰਦਾ ਹੈ ਦੂਜੇ ਪਾਸੇ ਦੂਜੇ ਬੰਦੇ ਨੂੰ ਜੇ ਅਸੀਂ ਕਾਲੇ ਕੱਪੜੇ ਜਾਂ ਡਾਰਕ ਕਲਰ ਦੇ ਕੱਪੜੇ ਪਾਵਾਂਗੇ ਤਾਂ ਦੂਰ ਤੋਂ ਬੰਦੇ ਨੂੰ ਅਸੀਂ ਨਹੀਂ ਦਿਖਾਂਗੇ ਜਿਸ ਕਰਕੇ ਸਾਡੇ ਨਾਲ ਦੁਰਘਟਨਾ ਵੀ ਹੋ ਸਕਦੀ ਹੈ ਅਤੇ ਸਾਨੂੰ ਹਮੇਸ਼ਾ ਹੀ ਸਰਦੀਆਂ 'ਚ ਗਰਮ ਕੱਪੜੇ ਪਾ ਕੇ ਟੋਪੀ ਲੈ ਕੇ ਹੀ ਦੌੜਨਾ ਚਾਹੀਦਾ ਹੈ ਬਰਸਾਤ ਦੇ ਮੌਸਮ ਵਿੱਚ ਸਾਨੂੰ ਬੜੇ ਧਿਆਨ ਨਾਲ ਸੈਰ ਕਰਨੀ ਚਾਹੀਦੀ ਹੈ ਜਿਸ ਕਰਕੇ ਸਾਡਾ ਅਸੀਂ ਸੈਰ ਕਰਨ ਜਾਈਏ ਜੇ ਮੀਂਹ ਪਿਆ ਹੋਵੇ ਸਾਡਾ ਪੈਰ ਵੀ ਸਲਿੱਪ ਕਰ ਸਕਦਾ ਹੈ ਅੱਗੇ ਪਾਣੀ 'ਚ ਵੀ ਸਾਡਾ ਪੈਰ ਡਿੱਗ ਸਕਦਾ ਹੈ ਜਿਸ ਕਰਕੇ ਸਾਡਾ ਪੈਰ ਮੁੱਚ ਸਕਦਾ ਹੈ ਅਤੇ ਸਾਨੂੰ ਹੋਰ ਵੀ ਸਾਡੀ ਕਿਹਦੇ ਨਾਲ ਸਾਡੇ ਸਰੀਰ 'ਤੇ ਹੋਰ ਵੀ ਚੋਟਾਂ ਲੱਗ ਸਕਦੀਆਂ ਤੀ ਇਸ ਕਰਕੇ ਸਾਨੂੰ ਹਰ ਮੌਸਮ ਦੇ ਹਿਸਾਬ ਨਾਲ ਹੀ ਸੈਰ ਕਰਨੀ ਚਾਹੀਦੀ ਹੈ